ਸਾਡੇ ਪੰਜਾਬ ਰਾਜ ਦੀ ਪਰਿਭਾਸ਼ਾ ਪੰਜਾਬ ਪੰਜਾਬ ਰਾਜ ਦੀ ਪਰਿਭਾਸ਼ਾ ਸਾਡਾ ਪੰਜਾਬ ਵਿਰਸਾ ਹੀ ਹੈ ਪੰਜਾਬ ਵਿਰਸਾ ਸਾਡਾ ਪੰਜਾਬ ਸੱਭਿਆਚਾਰਕ ਬੋਲੀ ਦੇ ਨਾਲ ਹੀ ਜੁੜ ਗਿਆ ਹੈ ਅਤੇ ਸਾਡੇ ਇਸ ਵਿੱਚ ਇੱਧਰ ਸਾਡੇ ਪੰਜਾਬ 'ਚ ਹੀ ਪੰਜਾਬੀ ਦੇ ਪੰਜਾਬ ਦੇ ਵਿਰਸੇ ਨਾਲ ਹੀ ਜੁੜੀਆਂ ਹੋਈਆਂ ਇਮਾਰਤਾਂ ਨੇ ਜਿਵੇਂ ਸਾਡੇ ਗੁਰਦੁਆਰਾ ਸਾਹਿਬ ਪੰਜਾਬੀ ਵਿਰਸੇ ਨਾਲ ਹੀ ਹੈ ਜੁੜੇ ਹੋਏ ਜਿਵੇਂ ਦੂਰੋ ਦੂਰੋ ਆ ਕੇ ਇੱਥੇ ਆਉਂਦੇ ਨੇ ਅਤੇ ਮੱਥਾ ਟੇਕਣ ਗੁਰਦੁਆਰਾ ਸਾਹਿਬ ਉਹ ਪੰਜਾਬੀ 'ਚ ਹੀ ਅਗਾਂਹ ਫਤਹਿ ਬੁਲਾਉਂਦੇ ਨੇ ਪੰਜਾਬੀ ਵਿਰਸੇ ਨੇ ਹੀ ਅਗਾਹਾਂ ਗੱਲ ਕਰਦੇ ਨੇ ਸਾਡੇ ਨਾਲ ਅਤੇ ਜਿਵੇਂ ਦੂਰੋਂ ਦੂਰੋਂ ਆਉਂਦੇ ਨੇ ਸਾਰੇ ਇੱਧਰ ਪੰਜਾਬੀ ਇਸੀ ਗੱਲ ਕਰਦੇ ਨੇ ਤਾਂ ਉਹ ਬੜਾ ਮਾਣ ਮਹਿਸੂਸ ਕਰਦੇ ਨੇ ਸਾਡੇ ਇੱਧਰ ਆ ਕੇ ਕਿਸੇ ਇਹ ਪੰਜਾਬੀ ਆਪਣੇ ਵਿਰਸੇ ਨੇ ਹੀ ਜੁੜੇ ਹੋਏ ਨੇ ਤੇ ਪੰਜਾਬੀ ਇਸ ਹੀ ਗੱਲ ਕਰ ਰਹੇ ਨੇ ਅਤੇ ਤਾਂ ਕਰਕੇ ਅਸੀਂ ਪੰਜਾਬੀ ਆਂ ਪੰਜਾਬੀ ਬੋਲਣਾ ਚਾਹੁੰਦੇ ਹਾਂ ਅਤੇ ਪੰਜਾਬੀ ਸਾਡਾ ਵਿਰਸਾ ਅਤੇ ਪੰਜਾਬੀ ਸਾਡਾ ਰਾਜ ਆ ਅਤੇ ਪੰਜਾਬੀ ਸਾਡਾ ਸਾਰਾ ਕੁਛ ਪੰਜਾਬ ਹੀ ਆ ਜੀ ਕਿਉਂ ਅਸੀਂ ਪੰਜਾਬ ਦੇ ਨਾਲ ਹੀ ਜੁੜੇ ਹੋਏ ਹਾਂ ਠੀਕ ਹੈ ਜੀ ਅਤੇ ਸਤਿ ਸ਼੍ਰੀ ਅਕਾਲ